ਬਹੁਤ ਸਾਰੀਆਂ ਸਰਕਾਰੀ ਅ ਜਿਹੜੀਆਂ ਸਕੀਮਾਂ ਜਾਂ ਪਹਿਲ ਕਦਮੀਆਂ ਨੇ ਜੋ ਗੌਰਮੈਂਟ ਦੇ ਦੁਆਰਾ ਕੀਤੀਆਂ ਗਈਆਂ ਨੇ ਸਾਡੇ ਜ਼ਿਲ੍ਹੇ ਦੇ ਵਿੱਚ ਔਰ ਉਹਨਾਂ ਦਾ ਜਿਹੜਾ ਮੇਨ ਮਕਸਦ ਹੈ ਉਹ ਸਿਰਫ ਅਤੇ ਸਿਰਫ ਇੱਕੋ ਹੀ ਹੈ ਕਿ ਲੋਕਾਂ ਦੀ ਜਿਹੜੀ ਸਿਹਤ ਹੈ ਉਹਦੇ ਵਿੱਚ ਸੁਧਾਰ ਹੋ ਸਕੇ ਲੋਕ ਮਤਲਬ ਘੱਟ ਤੋਂ ਘੱਟ ਬਿਮਾਰ ਹੋਣ ਔਰ ਇਹਨਾਂ ਵਿੱਚੋਂ ਦੋ ਜਿਹੜੀਆਂ ਮੇਨ ਪਹਿਲ ਕਦਮੀਆਂ ਨੇ ਜਿਹੜੀਆਂ ਗੌਰਮੈਂਟ ਨੇ ਕੀਤੀਆਂ ਨੇ ਉਹਦੇ ਬਾਰੇ ਮ ਮੈਂ ਥੋੜ੍ਹਾ ਜਿਹਾ ਚਾਨਣਾ ਪਾਉਣ ਲੱਗੀ ਹਾਂ ਜਿਹੜੀ ਸਭ ਤੋਂ ਪਹਿਲੀ ਪਹਿਲ ਕਦਮੀ ਮੈਨੂੰ ਲੱਗੀ ਰੀਸੈਨਟਲੀ ਉਹਦੇ ਵਿੱਚ ਜਿਹੜੀਆਂ ਸੀ ਐੱਮ ਵੱਲੋਂ ਜਿਹੜੀਆਂ ਇਹ ਖੋਲ੍ਹੀਆਂ ਗਈਆਂ ਨੇ ਮੁਹੱਲਾ ਕਲੀਨਿਕ ਖੋਲ੍ਹੀਆਂ ਗਈਆਂ ਨੇ ਔਰ ਇਹ ਇਹਨਾਂ ਦਾ ਮੁੱਖ ਮਕਸਦ ਜਿਹੜਾ ਹੈ ਉਹ ਲੋਕਾਂ ਦੀ ਸਿਹਤ ਦੇ ਵਿੱਚ ਸੁਧਾਰ ਕਰਨਾ ਹੈ ਹਾਲ ਹੀ ਦੇ ਵਿੱਚ ਇਹਨਾਂ ਦਾ ਉਦਘਾਟਨ ਕੀਤਾ ਗਿਆ ਹੈ ਔਰ ਬਹੁਤ ਸਾਰੇ ਜਿਹੜੇ ਮੁਲਾਜ਼ਮ ਨੇ ਜਿਹਨਾਂ ਨੂੰ ਜਿਹੜੀਆਂ ਜੋਬ ਸਰਕਾਰੀ ਜੋਬ ਨਹੀਂ ਮਿਲ ਰਹੀਆਂ ਸੀ ਉਹਨਾਂ ਨੂੰ ਰੁਜ਼ਗਾਰ ਜਿਹੜਾ ਹੈ ਇਹਨਾਂ ਦੇ ਜ਼ਰੀਏ ਮਿਲਿਆ ਹੈ ਨਾਲ ਦੀ ਨਾਲ ਦੂਜਾ ਇਹਦਾ ਫਾਇਦਾ ਇਹ ਹੋਇਆ ਹੈ ਕਿ ਲੋਕ ਜਿਹੜੀ ਫਰੀ ਸੇਵਾ ਹੈ ਉਹ ਲੈ ਰਹੇ ਨੇ ਅਤੇ ਉਹਨਾਂ ਦੀ ਸਿਹਤ ਪੱਖੋਂ ਉਹਨਾਂ ਦਾ ਸੁਧਾਰ ਜਿਹੜਾ ਉਹ ਹੋ ਰਿਹਾ ਹੈ ਦੂਸਰੀ ਜਿਹੜੀ ਮੇਨ ਚੀਜ਼ ਹੈ ਉਹ ਜ ਹਰ ਪੰਜਾਬ ਦੇ ਜ਼ਿਲ੍ਹੇ ਦੇ ਵਿੱਚ ਜਿਹੜੇ ਯੋਗਾ ਅਧਿਕਾਰੀ ਨੇ ਉਨ੍ਹਾਂ ਨੂੰ ਨਿਯੁਕਤ ਕੀਤਾ ਗਿਆ ਹੈ ਔਰ ਨਿਯੁਕਤ ਕਰਕੇ ਉਹ ਲੋਕਾਂ ਨੂੰ ਯੋਗ ਦੀ ਸਾਡੀ ਜ਼ਿੰਦਗੀ ਦੇ ਵਿੱਚ ਕੀ ਖੇਤਰ ਹੈ ਜਾਂ ਕੀ ਸਥਾਨ ਹੈ ਉਸ ਚੀਜ਼ ਨੂੰ ਉਹ ਸਮਝਾਉਂਦੇ ਨੇ ਔਰ ਹਰ ਸਿਟੀ ਦੇ ਵਿੱਚ ਜਿਹੜੇ ਇਹ ਯੋਗਾ ਅਧਿਕਾਰੀ ਨੇ ਉਹਨਾਂ ਨੂੰ ਭਰਤੀ ਕੀਤਾ ਗਿਆ ਹੈ ਔਰ ਸਵੇਰੇ ਸ਼ਾਮ ਉਹ ਜਿਹੜੇ ਅਲੱਗ ਅਲੱਗ ਲੋਕ ਨੇ ਮੁਹੱਲਿਆਂ ਦੇ ਵਿੱਚ ਰਹਿੰਦੇ ਉਹਨਾਂ ਨੂੰ ਇਹਦੇ ਪ੍ਰਤੀ ਜਾਗਰੂਕ ਕਰਦੇ ਨੇ ਉਹਨਾਂ ਨੂੰ ਮੁਫ਼ਤ ਦੇ ਵਿੱਚ ਜਿਹੜੀ ਯੋਗਾ ਦੀ ਟ੍ਰੇਨਿੰਗ ਦਿੰਦੇ ਨੇ ਔਰ ਇਸ ਟ੍ਰੇਨਿੰਗ ਦੇ ਜ਼ਰੀਏ ਲੋਕਾਂ ਦੀ ਜਿਹੜੀ ਸਿਹਤ ਹੈ ਉਹਦਾ ਕਾਫੀ ਜ਼ਿਆਦਾ ਸੁਧਾਰ ਅ ਹੋਇਆ ਹੈ ਹੁਣ ਗੱਲ ਕਰਦੇ ਹਾਂ ਕਿ ਅਸੀਂ ਇਹਦੇ ਬਾਰੇ ਜਿਹੜੀ ਅਰਜ਼ੀ ਹੈ ਉਹ ਕਿਵੇਂ ਦਿੰਦੇ ਹਾਂ ਜਾਂ ਸਾਨੂੰ ਇਹਦੇ ਬਾਰੇ ਕਿਵੇਂ ਪਤਾ ਚੱਲਦਾ ਹੈ ਤੋ ਇਹਦੇ ਵਿੱਚ ਸਭ ਤੋਂ ਪਹਿਲੇ ਜਿਹੜੀ ਚੀਜ਼ ਹੈ ਉਹ ਇਹ ਆਉਂਦੀ ਹੈ ਕਿ ਗੌਰਮੈਂਟ ਵੱਖਰੀਆਂ ਵੱਖਰੀਆਂ ਸਕੀਮਾਂ ਇਹਨਾਂ ਦੀਆਂ ਮਸ਼ਹੂਰੀਆਂ ਜਿਹੜੀਆਂ ਨੇ ਉਹ ਐਡਵਰਟਾਈਜਮੈਂਟ ਜਿਹਨੂੰ ਆਪਾਂ ਕਹਿੰਦੇ ਹਾਂ ਉਹ ਟੀ ਵੀ 'ਤੇ ਵੀ ਆਉਂਦੀਆਂ ਨੇ ਅਖ਼ਬਾਰਾਂ 'ਚ ਵੀ ਆਉਂਦੀਆਂ ਨੇ ਔਰ ਇੰਪਲੋਏਮੈਂਟ ਐਕਸਚੇਂਜ ਵਿੱਚ ਵੀ ਇਹਦੇ ਬਾਰੇ ਦੱਸਿਆ ਜਾਂਦਾ ਹੈ ਅਤੇ ਫਿਰ ਅਸੀਂ ਜਾ ਕੇ ਔਨਲਾਈਨ ਜਿਹੜੇ ਆਪਣੇ ਫਾਰਮ ਨੇ ਉਹਨਾਂ ਨੂੰ ਭਰਦੇ ਹਾਂ ਅਤੇ ਉਹਨਾਂ ਫਾਰਮਾਂ ਦੇ ਜ਼ਰੀਏ ਜਿਹੜੀ ਇਹ ਹੈ ਅ ਭਰਤੀ ਹੈ ਉਹ ਸਾਡੀ ਹੁੰਦੀ ਹੈ